ਮੈਂ ਬਹੁਤ ਕਿਤਾਬਾਂ ਪੜ੍ਹਦਾ ਰਿਹਾ ਬਹੁਤ ਕਿਤਾਬਾਂ ਪੜ੍ਹੀਆਂ ਜੋ ਕੁਝ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਹਨ ਕਿ ਜਦ ਆਪਾਂ ਪੜ੍ਹਨਾ ਸ਼ੁਰੂ ਕਰਦੇ ਵਧੀਆ ਲੱਗਦੀਆਂ ਹਨ ਉਹ ਸ਼ੁਰੂ ਤੋਂ ਹੀ ਕੁਝ ਕਿਤਾਬਾਂ ਇਹੋ ਜਿਹੀਆ ਹੁੰਦੀਆਂ ਹਨ ਜਿੰਨਾਂ ਨੂੰ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਪਹਿਲਾਂ ਪਹਿਲਾਂ ਪਸੰਦ ਨਹੀਂ ਆਉਂਦੀਆਂ ਪਰ ਬਾਅਦ ਵੀ ਜਿਵੇਂ ਜਿਵੇਂ ਆਪਾਂ ਪੜ੍ਹਦੇ ਜਾਂਦੇ ਹਾਂ ਤਾਂ ਹੋਰ ਵਧੀਆ ਲੱਗਣ ਲੱਗ ਪੈਂਦੀਆਂ ਅਸੀਂ ਇੱਕ ਤਰ੍ਹਾਂ ਕਹਿ ਸਕਦੇ ਕਿ ਸਟੋਰੀ ਬਣਦੀ ਜਾਂਦੀ ਪਹਿਲਾਂ ਨਹੀਂ ਵਧੀਆ ਲੱਗਦੀ ਬਾਅਦ ਵਿੱਚ ਇਸ ਤਰ੍ਹਾਂ ਸਟੋਰੀ ਬਣਦੀ ਜਾਂਦੀ ਹੈ ਅੱਖਾਂ ਮੁਹਰੇ ਸਾਡੇ ਦ੍ਰਿਸ਼ ਬਣਦਾ ਏ ਆਪਾਂ ਨੂੰ ਬਹੁਤ ਪਸੰਦ ਆਉਂਦਾ ਏ ਮੈਂ ਤੁਹਾਨੂੰ ਦੱਸਦਾ ਇਸ ਤਰ੍ਹਾਂ ਹੀ ਮੈਂ ਬਾਰਵੀਂ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ ਜਦ ਤਾਂ ਇੱਕ ਕਿਤਾਬ ਲਈ ਮੈਂ ਅਚਾਨਕ ਏ ਦਿਲ ਮੈਨੂੰ ਦੇਖਣ ਤੋਂ ਹੀ ਵਧੀਆ ਲੱਗੀ ਉੱਪਰ ਕਵਰ ਤੋਂ ਹੀ ਮੈਂ ਲੈ ਲਈ ਕਿਤਾਬ ਦਾ ਨਾਮ ਸੀਗਾ ਐਲਚਾਪੋ ਐਲਚਾਪ 'ਤੇ ਇੱਕ ਕਿਤਾਬ ਸੀ ਪਾਬਲੋ ਐਸਕੋਬਾਰ ਪਾਬਲੋ ਐਸਕੋਬਾਰ ਜਦ ਮੈਂ ਪੜ੍ਹਨੀ ਸ਼ੁਰੂ ਕੀਤੀ ਤਾਂ ਪਹਿਲਾ ਪਹਿਲਾ ਪੜ੍ਹਨੀ ਸ਼ੁਰੂ ਕੀਤੀ ਕੁਝ ਨਹੀਂ ਇੱਕ ਪਾਵਲੋ ਸਮੱਗਲਰ ਸੀ ਉਹਨੇ ਆਪਣੀ ਕਿਤਾਬ ਉਹਦੇ ਉੱਪਰ ਕਿਤਾਬ ਲਿਖੀ ਹੋਈ ਸੀ ਉਹਦਾ ਜੀਵਨ ਬਾਰੇ ਦੱਸ ਰਹੇ ਸੀ ਕਿਵੇਂ ਛੋਟਾ ਹੁੰਦਾ ਸੀ ਉਹ ਚੋਰੀਆਂ ਕਰਦਾ ਰਿਹਾ ਹੌਲੀ ਹੌਲੀ ਕਿਸੇ ਸਮੱਗਲਰ ਦੇ ਨਾਲ ਕੰਮ ਕਰਨ ਲੱਗ ਪਿਆ ਯਾਨੀ ਕਿ ਕਹਿ ਸਕਦੇ ਹੋ ਕਿ ਵੀਹ ਪੱਚੀ ਸਫੇ ਇਹੋ ਜਿਹੇ ਸਨ ਕਿ ਪੜ੍ਹਨ ਵਿੱਚ ਕੋਈ ਮਜ਼ਾ ਹੀ ਨਹੀਂ ਆ ਰਿਹਾ ਸੀ ਪਾਬਲੋ ਬਾਰੇ ਉਹਨੇ ਆਪਣੀ ਲਾਈਫ ਦੱਸ ਦਿੱਤੀ ਯਾ ਕੰਮ ਕਰਦਾ ਸੀ ਧੱਕੇ ਖਾ ਰਿਹਾ ਸੀ ਗਰੀਬ ਸੀ ਕੁਝ ਵੀ ਹੌਲੀ ਹੌਲੀ ਜਿਵੇਂ ਦੱਸਿਆ ਕਿ ਉਹ ਬੜਾ ਹੁੰਦਾ ਗਿਆ ਉਹ ਇੱਕ ਵਧੀਆ ਸਮੱਗਲਰ ਬਣਦਾ ਗਿਆ ਆਪਣੀ ਲਾਈਫ ਵਿੱਚ ਉਹਨੇ ਬੜੇ ਤੋਂ ਬੜੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ ਬੜੇ ਬੜੇ ਡੀਲਰਾਂ ਨਾਲ ਹੱਥ ਮਿਲਾਇਆ ਇਸ ਤਰ੍ਹਾਂ ਸਟੋਰੀ ਬਣਦੀ ਗਈ ਕਿ ਉਹ ਆਪਣੇ ਦੇਸ਼ ਤੋਂ ਬਾਹਰ ਹੋਰ ਦੇਸ਼ਾਂ ਦੇ ਵਿੱਚ ਵੀ ਨਸ਼ਾ ਵੇਚਣ ਲੱਗਿਆ ਉਹਦਾ ਨਾਮ ਹੁੰਦਾ ਗਿਆ ਇਸ ਤਰ੍ਹਾਂ ਸਟੋਰੀ ਅੱਖਾਂ ਮੁਹਰੇ ਆਉਂਦੀ ਗਈ ਜਿਵੇਂ ਜਿਵੇਂ ਅਸੀਂ ਅੱਗੇ ਪੜ੍ਹਿਆ ਇੰਟਰਸਟ ਇੰਨਾ ਹੁੰਦਾ ਗਿਆ ਦਿਲਚਸਪੀ ਵੱਧਦੀ ਗਈ ਕਿ ਹਾਂ ਅੱਗੇ ਕੀ ਹੋਉਂਗਾ ਜਿੱਦਾਂ ਜਿੱਦਾਂ ਪੜ੍ਹਦਾ ਗਿਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨੇ ਦੇਸ਼ ਦੀ ਰਾਸ਼ਟਰਪਤੀਆਂ ਨਾਲ ਵੀ ਸਮਝੌਤਾ ਕਰ ਲਿਆ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਨਸ਼ਾ ਵੇਚਣ ਦੇ ਲਈ ਬਹੁਤ ਜ਼ਿਆਦਾ ਨਸ਼ਾ ਵੇਚਣਾ ਸ਼ੁਰੂ ਕੀਤਾ ਉਹਨੇ ਇੰਨਾ ਜ਼ਿਆਦਾ ਪੈਸਾ ਕਮਾਉਣ ਲੱਗ ਪਿਆ ਸੋਚ ਕੇ ਹੈਰਾਨੀ ਹੁੰਦੀ ਸੀ ਕਿ ਇੰਨਾ ਜ਼ਿਆਦਾ ਪੈਸਾ ਇੱਕ ਦਿਨ ਉਹਦੀ ਲੜਕੀ ਬਿਮਾਰ ਹੋ ਗਈ ਕਿੰਨੇ ਅਰਬ ਡੋਲਰ ਉਹਨੇ ਅੱਗ ਲਗਾ ਕੇ ਜਾਲ ਦਿੱਤੇ ਦੋ ਲੱਖ ਦੀਆਂ ਰਬੜਾਂ ਲੈਂਦਾ ਸੀ ਉਹ ਨੋਟ ਬੰਨਣ ਨੂੰ ਇੱਕ ਹਫਤੇ ਵਿੱਚ ਕਾਫੀ ਦਿਲਚਸਪੀ ਗੱਲਾਂ ਆਉਂਦੀਆਂ ਗਈਆਂ ਅੱਗੇ ਤੋਂ ਅੱਗੇ ਅਤੇ ਬਹੁਤ ਇੰਟਰਸਟ ਬਣਦਾ ਗਿਆ ਮਨਪਸੰਦ ਬਣਦੀ ਗਈ ਜਿੱਦਾਂ ਜਿੱਦਾਂ ਕਿਤਾਬ ਦਾ ਐਂਡ ਹੁੰਦਾ ਗਿਆ ਅਖੀਰ ਪੰਨਿਆਂ 'ਤੇ ਪਹੁੰਚਦਾ ਗਿਆ ਉਹ ਹੋਰ ਹੀ ਦਿਲਚਸਪ ਬਣਦੀ ਗਈ ਬਹੁਤ ਵਧੀਆ ਸਟੋਰੀ ਬਣਾਈ ਅਤੇ ਸਟਾਰਟਿੰਗ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਨਹੀਂ ਕੁਝ ਵੀ ਨਹੀਂ ਆ ਦਿਲ ਕਰਦਾ ਨਹੀਂ ਸੀ ਪੜ੍ਹਨ ਨੂੰ ਜਿੱਦੇ ਅੱਗੇ ਤੋਂ ਅੱਗੇ ਪੜ੍ਹਦੇ ਗਏ ਇੰਨਾ ਦਿਲਚਸਪ ਬਣਿਆ ਕਿ ਇੰਨਾ ਦਿਲਚਸਪ ਬਣਿਆ ਦਿਲ ਇਸ ਤਰ੍ਹਾਂ ਕਰ ਰਿਹਾ ਸੀ ਕਿ ਕਾਸ਼ ਇਹ ਹੋਰ ਲੰਬੀ ਸਟੋਰੀ ਹੁੰਦੀ ਜ਼ਿਆਦਾ ਲੰਬੀ ਹੁੰਦੀ